ਦੋ ਫਰਵਰੀ ਦੋ ਹਜ਼ਾਰ ਬਾਰਾਂ ਪੰਜ ਅਕਤੂਬਰ ਦੋ ਹਜ਼ਾਰ ਪੰਦਰਾਂ ਦਸ ਅਪ੍ਰੈਲ ਦੋ ਹਜ਼ਾਰ ਅਠਾਰਾਂ ਬਾਰਾਂ ਦਸੰਬਰ ਦੋ ਹਜ਼ਾਰ ਉੱਨੀ ਅਠਾਰਾਂ ਜਨਵਰੀ ਦੋ ਹਜ਼ਾਰ ਤੇਈ